ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਚਾਚਾ ਭਤੀਜਾ ਢਾਬੇ ਤੋਂ ਖਾਣਾ ਔਡਰ ਕੀਤਾ ਸੀ ਜਿਸ ਵਿੱਚ ਕਿ ਦਾਲ ਮੱਖਣੀ ਕੜਾਹੀ ਪਨੀਰ ਪਨੀਰ ਦੀ ਭੁਰਜੀ ਚਿੱਟੇ ਛੋਲੇ ਚਾਵਲ ਰਾਇਤਾ ਸਲਾਦ ਦਸ ਸਿੰਪਲ ਰੋਟੀਆਂ ਪੰਜ ਤੰਦੂਰੀ ਰੋਟੀਆਂ ਇੱਕ ਡੱਬਾ ਆਈਸ ਕ੍ਰੀਮ ਸੀ ਸਾਡੇ ਘਰ ਮਹਿਮਾਨ ਆਏ ਹੋਏ ਹਨ ਮੈਂ ਉਹਨਾਂ ਨੂੰ ਹਾਲੇ ਤੱਕ ਚਾਹ ਸਨੈਕ ਦਿੱਤੇ ਹਨ ਪਰ ਖਾਣੇ ਦਾ ਟਾਈਮ ਹੋ ਗਿਆ ਹੈ ਸ ਤੁਹਾਡਾ ਖਾਣਾ ਹਾਲੇ ਤੱਕ ਨਹੀਂ ਪਹੁੰਚਿਆ ਤੁਹਾਡਾ ਡਿਲੀਵਰ ਮਤਲਬ ਤੁਹਾਡਾ ਡਿਲੀਵਰੀ ਬੋਆਏ ਹਾਲੇ ਤੱਕ ਨਹੀਂ ਪਹੁੰਚਿਆ ਕ ਮੈਂ ਇਸ ਕਰਕੇ ਆਪਣਾ ਮੈਂ ਇਸ ਕਰਕੇ ਆਪਣਾ ਔਡਰ ਕੈਂਸਲ ਕਰਨਾ ਚਾਹੁੰਦੀ ਹਾਂ ਕਿਰਪਾ ਕਰਕੇ ਮੈਨੂੰ ਇਹ ਦੱਸਿਆ ਜਾਵੇ ਕਿ ਤੁਸੀਂ ਜੋ ਮੈਂ ਔਨਲਾਈਨ ਪੇਮੈਂਟ ਕੀਤੀ ਸੀ ਉਹ ਤੁਸੀਂ ਮੈਨੂੰ ਔਨਲਾਈਨ ਮੇਰੇ ਪੇਟੀਐੱਮ 'ਤੇ ਗੂਗਲ ਪੇ 'ਤੇ ਜਾਂ ਫਿਰ ਮੈਨੂੰ ਬਾਏ ਹੈਂਡ ਦੇਵੋਂਗੇ ਤਾਂ ਮੈਂ ਅਗਰ ਤੁਸੀਂ ਬਾਏ ਹੈਂਡ ਦਿਉਂਗੇ ਤਾਂ ਮੈਂ ਤੁਹਾਡੇ ਢਾਬੇ ਤੋਂ ਆ ਕੇ ਲੈ ਕੇ ਜਾਵਾਂ ਜਾਂ ਫਿਰ ਤੁਸੀਂ ਆਪਣੇ ਕਿਸੇ ਡਿਲੀਵਰੀ ਬੋਆਏ ਜਾਂ ਕਿਸੇ ਦੇ ਹੱਥੋਂ ਸਾਡੇ ਪਿੰਡ ਪਹੁੰਚਾ ਸਕਦੇ ਹੋ ਕਿਰਪਾ ਕਰਕੇ ਮੇਰਾ ਜਲਦ ਤੋਂ ਜਲਦੀ ਮੇਰੀ ਪੇਮੈਂਟ ਵਾਪਸ ਕੀਤੀ ਜਾਵੇ ਧੰਨਵਾਦ